ਪੰਜਾਬੀ ਲੋਕਾਂ ਦੀ ਬੋਲੀ ਪਹਿਰਾਵੇ ਅਤੇ ਵੱਖਰੇ ਸੱਭਿਆਚਾਰ ਕਰਕੇ ਉਹਨਾਂ ਦੀ ਪਹਿਛਾਣ ਮੰਨੀ ਜਾਂਦੀ ਹੈ ਜਿਵੇਂ ਪੰਜਾਬੀ ਪਹਿਰਾਵਾ ਪਟਿਆਲਾ ਸ਼ਾਹੀ ਸੂਟ ਪਟਿਆਲਾ ਸ਼ਾਹੀ ਪੱਗ ਇਹ ਉਹਨਾਂ ਦੀ ਵੱਖਰੀ ਪਛਾਣ ਹੈ ਪੰਜਾਬੀ ਬੋਲੀ ਬੜੀ ਮਿੱਠੀ ਬੋਲੀ ਹੈ